ਪੰਜਾਬ ਸ਼ੁਰੂ ਦੇ ਵਿੱਚੋਂ ਹੀ ਵਪਾਰਕ ਖੇਤਰ ਦੇ ਵਿੱਚ ਅਗਰ ਨਹੀਂ ਰਿਹਾ ਹੈਗਾ ਅਗਰ ਉੱਨੀ ਸੌ ਸੰਤਾਲੀ ਤੋਂ ਬਾਅਦ ਆਜ਼ਾਦੀ ਦੇ ਟਾਈਮ ਦੇਖੀਏ ਤਾਂ ਵੀ ਜਿਹੜਾ ਪਾਕਿਸਤਾਨ ਤੋਂ ਜਿਹੜੇ ਬਹੁਤ ਸਾਰੇ ਜਿਹੜੇ ਉੱਜੜ ਕੇ ਆਏ ਇੱਥੇ ਪੰਜਾਬ 'ਚ ਵਸੇ ਅਤੇ ਉਹਨਾਂ ਨੇ ਬਿਜਨਸ ਹੀ ਸ਼ੁਰੂ ਕੀਤੇ ਬਿਜਨਸ ਦੇ ਵਿੱਚ ਵਾਧੇ ਕਰਦੇ ਚਲੇ ਗਏ ਅਤੇ ਅੱਜ ਪੰਜਾਬ ਜਿਹੜਾ ਉਹ ਤਰੱਕੀਆਂ ਦੀ ਰਾਹਾਂ 'ਤੇ ਹੈ ਜਿਵੇਂ ਇਹਦੇ 'ਚ ਅਲੱਗ ਅਲੱਗ ਡਿਸਟਰਿਕਟ ਹੈ ਪਟਿਆਲਾ ਲੁਧਿਆਣਾ ਅੰਮ੍ਰਿਤਸਰ ਜਲੰਧਰ ਬਠਿੰਡਾ ਮਤਲਬ ਅਗਰ ਆਪਾਂ ਇਹਨਾਂ ਨੂੰ ਹਿੱਸਿਆਂ 'ਚ ਵੰਡੀਏ ਤਾਂ ਮਾਲਵਾ ਬੈਲਟ ਹੋ ਗਈ ਇੱਧਰੋਂ ਮਾਝਾ ਹੋ ਗਈ ਉੱਧਰੋਂ ਦੁਆਬਾ ਹੋ ਗਿਆ ਅਤੇ ਦੁਆਬਾ ਤਾਂ ਸ਼ੁਰੂ ਤੋਂ ਹੀ ਜਿਹੜਾ ਹੈਗਾ ਖੇਡਾਂ ਦੇ ਵਿੱਚ ਬੜਾ ਅੱਗੇ ਰਿਹਾ ਖੇਡਾਂ ਦੇ ਸਮਾਨ ਜਿਹੜੇ ਹੈਗੇ ਆ ਸਾਰੇ ਵਪਾਰਕ ਜਿਹੜਾ ਹੈ ਉਹ ਜਲੰਧਰ ਦੇ ਵਿੱਚ ਅੱਜ ਵੀ ਬੈਟ ਹਾਕੀ ਖੇਡਾਂ ਦਾ ਸਾਰਾ ਸਮਾਨ ਜਲੰਧਰ ਸ਼ਹਿਰ 'ਚ ਬਣਦਾ ਅਗਰ ਲੁਧਿਆਣੇ ਦੀ ਗੱਲ ਕਰੀਏ ਤਾਂ ਸਾਰਾ ਕੁਝ ਜਿਹੜਾ ਵਪਾਰਕ ਮੇ ਮੇਜਰ ਜਿਹੜਾ ਹੈ ਸਾਈਕਲ ਦੇ ਪਾਰਟਸ ਹੀਰੋ ਸਾਈਕਲ ਹੋਰ ਅਲੱਗ ਅਲੱਗ ਤਰ੍ਹਾਂ ਦੇ ਸਾਈਕਲਾਂ ਦੇ ਪਾਰਟਸ ਅਤੇ ਹੌਜ਼ਰੀ ਦਾ ਸਮਾਨ ਜਿਹੜਾ ਹੈਗਾ ਗਾਰਮੈਂਟਸ ਜਿਹੜੀਆਂ ਉਹ ਸਾਰੇ ਲੁਧਿਆਣਾ ਬਣਦੇ ਹੈ ਬਾਕੀ ਅਗਰ ਸ਼ਾਹੀ ਸ਼ਹਿਰ ਪਟਿਆਲਾ ਦੀ ਗੱਲ ਕਰੀਏ ਪਟਿਆਲਾ ਦੇ ਵਿੱਚ ਵਪਾਰਕ ਮੇਲੇ ਅਕਸਰ ਲੱਗਦੇ ਰਹਿੰਦੇ ਹੈ ਅਤੇ ਅੰਮ੍ਰਿਤਸਰ ਵੀ ਜਿਹੜਾ ਹੈਗਾ ਉਹ ਹੋਲੀ ਸਿਟੀ ਦੇ ਨਾਮ 'ਤੇ ਜਾਣਿਆ ਜਾਂਦਾ ਇਸ 'ਚ ਵੀ ਵਪਾਰ ਦੇ ਵਿੱਚ ਪੂਰਾ ਸਮਰਪਿਤ ਹੈ ਵਪਾਰ ਨੂੰ ਇਹਦੇ 'ਚ ਟੂਰਿਸਟ ਵੀ ਬਹੁਤ ਆਉਂਦਾ ਹੈਗਾ ਟੂਰਿਜ਼ਮ ਦੀ ਵੀ ਇੱਥੇ ਡਿਵੈਲਪਮੈਂਟ ਹੈ ਨਾਲ ਅਧਿਆਤਮਿਕ ਦਾ ਜਿਹੜਾ ਰੂਪ ਹੈ ਜਿਹੜਾ ਉਹ ਸਾਨੂੰ ਪਤਾ ਹੀ ਹੈ ਦੁਰਗਿਆਨਾ ਟੈਂਪਲ ਅਤੇ ਗੋਲਡਨ ਟੈਂਪਲ ਬੜੇ ਮਸ਼ਹੂਰ ਆ ਉੱਥੇ ਨਾਲ ਹੀ ਹੋਰ ਪਾਸੇ ਸੱਭਿਆਚਾਰ ਦੀ ਗੱਲ ਕਰੀਏ ਸਾਡੇ ਕੋਲ ਜਲਿਆਂਵਾਲਾ ਬਾਗ ਹੈ ਸਾਡੀਆਂ ਪੁਰਾਣੀਆਂ ਯਾਦਾਂ ਜਿਹੜੀ ਆਜ਼ਾਦੀ ਤੋਂ ਪਹਿਲਾਂ ਜਿਹੜਾ ਜਿਹੜੇ ਉੱਥੇ ਯੋਧਿਆਂ ਨੇ ਜਿਹੜੇ ਆਜ਼ਾਦੀ ਦੇ ਯੋਧਿਆਂ ਨੇ ਜਿਹੜਾ ਸੀਸ ਕਟਾਏ ਕਈਆਂ ਨੇ ਆਪਣੇ ਆਪਣੇ ਸ਼ਹਾਦਤਾਂ ਦਿੱਤੀਆਂ ਉਹ ਸਾਰੇ ਜਿਹੜੇ ਚਿੰਨ੍ਹ ਆ ਉੱਥੇ ਜਲਿਆਂਵਾਲਾ ਬਾਗ ਦੇ ਵਿੱਚ ਮੌਜੂਦ ਹੈ ਅੱਜ ਵੀ ਅਗਰ ਗੱਲ ਕਰੀਏ ਤਾਂ ਜਿਹੜਾ ਵਾਹਗਾ ਬਾਰਡਰ ਹੈ ਉਹ ਸਾਨੂੰ ਪੰਜਾਬ ਅਤੇ ਪਾਕਿਸਤਾਨ ਦੀ ਜਿਹੜੀ ਸੀਮਾ ਦੇ ਨਾਲ ਲੱਗਦਾ ਏਰੀਆ ਹੈ ਉੱਥੇ ਪਰੇਡ ਹੋਇਆ ਕਰਦੀ ਹੈ ਸ਼ਾਮ ਨੂੰ ਉਹਦੇ 'ਚ ਵੀ ਵਪਾਰਕ ਸਥਾਨਕ ਜਿਹੜੇ ਲੋਕ ਹੈ ਉੱਥੇ ਆ ਕੇ ਆਪਣਾ ਵਪਾਰ ਕਰਦੇ ਜਿਹੜੇ ਜਿਹੜੇ ਬਾਹਰੋਂ ਲੋਕ ਆਏ ਹੁੰਦੇ ਆ ਉਹਨਾਂ ਦੀ ਸਰਵਿਸ ਉਹਨਾਂ ਨੂੰ ਦਿੰਦੇ ਹੈ ਅਤੇ ਜਿਹੜਾ ਪੰਜਾਬ ਦਾ ਜਿਹੜਾ ਸੱਭਿਆਚਾਰਕ ਹੈ ਉਹ ਸਾਰਾ ਵਪਾਰਕ ਨਾਲ ਸੰਬੰਧ ਰੱਖਦਾ